ਸਾਡੇ ਸ਼ਹਿਰ ਦੇ ਬਹੁਤ ਸਾਰੇ ਫੋਟੋ ਗਰਾਫਰ ਹਨ ਪਰ ਮੈਨੂੰ ਸਭ ਤੋਂ ਅਲਗ ਮੈਨੂੰ ਦੀਪਕ ਦੀ ਫੋਟੋਗਰਾਫੀ ਸਭ ਤੋਂ ਵਧੀਆ ਲੱਗਦੀ ਹੈ ਅਤੇ ਸਭ ਤੋਂ ਜਿਆਦਾ ਮੈਨੂੰ ਉਸ ਦੀ ਫੋਟੋਗ੍ਰਾਫੀ ਵਧੀਆ ਲੱਗਦੀ ਹੈ ਕਿਉਂਕਿ ਉਸ ਕੋਲ ਸਭ ਤੋਂ ਲੇਟੈਸਟ ਕੈਮਰਾ ਹੈ ਅਤੇ ਉਸਦੀ ਫੋਟੋ ਖਿੱਚਣ ਦੀ ਕਲਾ ਵੀ ਬਹੁਤ ਹੀ ਵਧੀਆ ਹੈ ਉਹ ਫੋਟੋ ਖਿੱਚਣ ਤੋਂ ਬਾਅਦ ਹਰ ਕਿਸੇ ਨੂੰ ਸਮਾਰਟ ਬਣਾ ਦਿੰਦਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਦੀਪਕ ਕੋਲੋਂ ਫੋਟੋਗ੍ਰਾਫੀ ਕਰਵਾਓ